ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਜੀ ਅੱਛਾ ਅੱਛਾ ਜੀ ਕਰੋ ਠੀਕ ਆ ਜੀ ਕੀ ਸੇਵਾ ਕਰ ਸਕਦੇ ਹਾਂ ਜੀ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਜੀ ਤੁਹਾਡੀ ਅਸੀਂ ਕਿਹੜੇ ਪਾਸੇ ਠੀਕ ਆ ਠੀਕ ਆ ਠੀਕ ਆ ਜੀ ਸਰਪੰਚ ਕੌਣ ਨੇ ਹੁਣ ਤੁਹਾਡੇ ਮੌਜੂਦਾ ਅਤੇ ਉਹ ਸੁਣਵਾਈ ਕਰਦੇ ਨਹੀਂ ਕੋਈ ਉਹਨਾਂ ਵੱਲੋਂ ਐਪਲੀਕੇਸ਼ਨ ਜੀ ਚਲੋ ਉਹ ਵੀ ਮੈਂ ਨੋਟਿਸ 'ਤੇ ਲਿਆਉਣਾ ਗੱਲ ਹਾਂਜੀ ਦੱਸੋ ਤੁਸੀਂ ਕਿਹੜੀ ਸੜਕ ਦਾ ਨਹੀਂ ਨਹੀਂ ਬਹੁਤ ਬਹੁਤ ਨਹੀਂ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੁਹਾਡੀ ਸੇਵਾ ਲਈ ਹੀ ਆ

ਇਹ ਸੜਕ ਕਿੱਥੋਂ ਤੇ ਮੈਨੂੰ ਨਾ ਦੱਸੋ ਸਹੀ ਜਾਂ ਤੁਸੀਂ ਕੋਈ ਪਿੰਡ ਕੰਨਿਓ ਲਿਖ ਕੇ ਹਾਂ ਆਫਿਸ 'ਚ ਪਹੁੰਚੋ ਜੇ ਮੈਂ ਨਾ ਵੀ ਹੋਇਆ ਤਾਂ ਉੱਥੇ ਮੁੰਡਾ ਹੋਊ ਕੋਈ ਹਾਂ ਫਿਰ ਆਪਾਂ ਮਤਾ ਪਾ ਲਾਂਗੇ ਉਹ ਹਾਂ ਪਿੰਡ 'ਚੋਂ ਕਰਵਾ ਦਾਂਗੇ ਕੋਈ ਨਾ ਕੋਈ ਹਾਂ ਅੱਛਾ ਜੀ

ਨਹੀਂ ਐਂ ਹੁੰਦਾ ਦੇਖੋ ਉਹਨਾਂ ਦੇ ਹੱਥ ਵੱਸ ਵੀ ਨਹੀਂ ਨਾ ਹੁੰਦਾ ਸਾਰਾ ਕੁਛ ਹਾਂ ਜੇ ਉਹਨਾਂ ਕੋਲ ਕੁਛ ਆਊ ਤਾਂ ਹੀ ਕਰਨਗੇ ਨਾ ਉਹ ਵੀ ਹਾਂ ਥੋੜ੍ਹਾ ਮੋਟਾ ਆਪਸੀ ਕਈ ਵਾਰੀ ਪਿੰਡ ਦਾ ਹੁੰਦਾ ਨਾ ਉਹ ਚੀਜ਼ਾਂ ਨੂੰ ਤੁਸੀਂ ਛੱਡੋ ਹਾਂ ਹਾਂ ਬਿਲਕੁਲ ਬਿਲਕੁਲ ਆਹ ਗੱਲ ਕਰੋ ਤੁਸੀਂ ਉਹਨੂੰ ਛੱਡੋ ਫਿਰ ਤੁਸੀਂ ਲੈ ਕੇ ਆਓ ਫਿਰ ਇੱਥੇ ਪਹੁੰਚੋ ਕੋਈ ਨਾ ਜਿਹੜੇ ਜਿਹੜੇ ਵੀ ਕੰਮ ਨੇ ਜਾਂ ਕੋਈ ਤੁਸੀਂ ਪਿੰਡ 'ਚ ਮੀਟਿੰਗ ਰੱਖੋ ਅਸੀਂ ਪਹੁੰਚਦੇ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਆਓ ਸਮਾਂ ਲਓ ਠੀਕ ਹੈ ਜੀ ਜ਼ਰੂਰ ਪਹੁੰਚੋ ਜੀ ਅਸੀਂ ਸੇਵਾ ਲਈ ਹਾਂ ਪਰ ਐਂ ਹੁੰਦਾ ਦੇਖੋ ਕੰਮ ਹੋਵੇਗਾ ਲਾਈਨ ਵਾਈਜ਼ ਹਾਂ ਥੋੜ੍ਹਾ ਜਿਹਾ ਸਬਰ ਤੁਹਾਨੂੰ ਵੀ ਰੱਖਣਾ ਪੈਣਾ ਅਤੇ ਅਸੀਂ ਵੀ ਇੱਧਰੋਂ ਪੂਰਾ ਕੋਸ਼ਿਸ਼ ਕਰਾਂਗੇ ਸਾਰੇ ਪਿੰਡਾਂ ਦਾ ਹੀ ਹੁੰਦਾ ਨਾ ਤੇ ਥੋੜ੍ਹਾ ਥੋੜ੍ਹਾ ਸਾਰਿਆਂ ਦਾ ਹੀ ਹੋ ਜਾਵੇ ਹਾਂ ਇਹਦੇ ਧੰਨਵਾਦ ਕਿਉਂ ਤੁਸੀਂ ਵੋਟਾਂ ਪਾਈਆਂ ਨੇ ਤੁਹਾਡਾ ਹੱਕ ਆ ਬਿਲਕੁਲ ਫਿਰ ਜ਼ਰੂਰ ਕੰਮ ਜੇ ਦੱਸੋਂਗੇ ਤਾਂ ਹੀ ਹੋਣਗੇ ਨਾ ਬਿਲਕੁਲ ਮੈਨੂੰ ਤਾਂ ਖੁਸ਼ੀ ਹੋਈ ਤੁਸੀਂ ਕੰਮ ਦੱਸਿਆ ਪਿੰਡ ਵਾਸੀਆਂ ਨੇ ਨਹੀਂ ਅਗਲਾ ਕਹਿੰਦਾ ਮੈਂ ਕਿਉਂ ਪੰਗਾ ਲਵਾਂ ਜਾਂ ਕੀ ਕਰਾਂ ਹੈ ਨਾ ਹੂੰ ਹੂੰ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂ ਹਾਂ ਦੱਸੋ ਬਿਲਕੁਲ

ਨਾ ਨਾ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਨਹੀਂ ਨਹੀਂ ਨਹੀਂ ਬਿਲਕੁਲ ਬਿਲਕੁਲ ਬਿਲਕੁਲ ਮੈਂ ਤਾਂ ਕਹਿੰਦਾ ਨੌਜਵਾਨ ਮੂਹਰੇ ਆਉਣ ਵੱਧ ਤੋਂ ਵੱਧ ਉਹ ਤਾਂ ਤੁਸੀਂ ਕਰਵਾਓ ਜਾ ਕੇ ਕੋਈ ਨਾ ਜਿੱਥੇ ਕਿਤੇ ਲੋੜ ਹੋਈ ਮੇਰੀ ਫੋਨ 'ਤੇ ਗੱਲ ਕਰਵਾ ਦਿਓ ਜੇ ਕੋਈ ਪ੍ਰੋਬਲਮ ਆਈ ਹੈਂ ਹਾਂ ਚਲੋ ਮੈਂ ਵੀ ਅੱਗੇ ਮੀਟਿੰਗ 'ਚ ਜਾਣਾ ਸੀਗਾ ਅਤੇ ਤੁਸੀਂ ਕੇ ਫਿਰ ਮੈਨੂੰ ਕਾਲ ਕਰਿਓ ਠੀਕ ਹੈ ਓਕੇ ਠੀਕ ਆ ਜੀ ਸਤਿ ਸ਼੍ਰੀ ਅਕਾਲ